ਸਤਿ ਸ਼੍ਰੀ ਅਕਾਲ ਭਾਅ ਜੀ ਤੁਸੀਂ ਭਾਅ ਜੀ ਟ੍ਰਾਂਸਪੋਰਟ ਏਜੰਸੀ ਢਿੱਲੋਂ ਜਾਂ ਟ੍ਰਾਂਸਪੋਰਟ ਏਜੰਸੀ ਤੋਂ ਬੋਲਦੇ ਸਰ ਮੈਂ ਤੁਹਾਡੇ ਬਾਰੇ ਦੱਸਣਾ ਚਾਹੁੰਦਾ ਤੁਹਾਡੇ ਜਿਹੜੀ ਮੈਂ ਕੈਬ ਕੀਤੀ ਸੀ ਅਸੀਂ ਟ੍ਰਾਂ ਦਿੱਲੀ ਏਅਰਪੋਰਟ ਨੂੰ ਗਏ ਸੀ ਉਹਦੇ ਵਿੱਚ ਨਾ ਤਾਂ ਡਰਾਈਵਰ ਨੇ ਜੀ ਮਾਸਕ ਪਹਿਨਿਆ ਸੀ ਉਸ ਕਿਉਂਕਿ ਉਸ ਵੇਲੇ ਕੋਵਿਡ ਨਾਈਟੀ ਚੱਲਦਾ ਸੀ ਨਾ ਮਾਸਕ ਪਹਿਨਿਆ ਸੀ ਉਹਦੀ ਸੀਟਾਂ ਵੀ ਸਰ ਬਹੁਤ ਹੀ ਜ਼ਿਆਦੇ ਗੰਦੀਆਂ ਸੀ ਅਤੇ ਬਹੁਤ ਜ਼ਿਆਦੇ ਅਸਪਾਈਡ ਅਸਪਾਇਡ ਸੀ ਅਤੇ ਬਹੁਤ ਜ਼ਿਆਦੇ ਜਣੀ ਗੰਦ ਲੱਗਿਆ ਸਾਨੂੰ ਸੀਟਾਂ ਵਿੱਚ ਅਤੇ ਅਤੇ ਸਫਾਈ ਦਾ ਕੋਈ ਵੀ ਨਾ ਵੀ ਨਾ ਨਾ ਨਾਮੋ ਨਿਸ਼ਾਨ ਸੀ ਕੋਈ ਵੀ ਨਹੀਂ ਸੀ ਅਤੇ ਡਰਾਈਵਰ ਡਰਾਈਵਰ ਆਪਣੀ ਮਨਮਰਜ਼ੀ ਕਰਦਾ ਸੀ ਜੀ ਮਾਸਕ ਵੀ ਨਹੀਂ ਪਾਇਆ ਸੀ ਅਤੇ ਕੋਵਿਡ ਨਾਈਟੀ ਦਾ ਕਾਫ਼ੀ ਜ਼ੋਰ ਸੀ ਅਤੇ ਅਸੀਂ ਬਹੁਤ ਪਰੇਸ਼ਾਨ ਹੋਏ ਰਸਤੇ ਵਿੱਚ ਜਾ ਕੇ ਅਤੇ ਤੁਹਾਨੂੰ ਇਸ ਕਰਕੇ ਸ਼ਿਕਾਇਤ ਕਰ ਕਰਦੇ ਹਾਂ ਕਿ ਇਹਨੂੰ ਇਹ ਇਹਨੇ ਸਾਨੂੰ ਬਹੁਤ ਪਰੇਸ਼ਾਨ ਕੀਤਾ ਰਸਤੇ ਵਿੱਚ ਅਸੀਂ ਇਸ ਕਰਕੇ ਸੀਟਾਂ ਕ ਸੀਟਾਂ ਵਿੱਚ ਕਾਫ਼ੀ ਅਸੀਂ ਪਰੇਸ਼ਾਨ ਹੋਏ ਅਤੇ ਅਸੀਂ ਕਾਫ਼ੀ ਅਸੀਂ ਪਰੇਸ਼ਾਨੀ ਕੱਟੀ ਅਤੇ ਪਲੀਜ਼ ਤਾਂ ਹੀ ਅਸੀਂ ਤੁਹਾਡੀ ਤਾਂ ਹੀ ਤੁਹਾਡੇ ਕੋਲ ਇਨ ਇਹ ਦੀ ਸ਼ਿਕਾਇਤ ਕਰਨ ਲੱਗੇ ਜੀ ਅਸੀਂ ਬਹੁਤ ਪਰੇਸ਼ਾਨ ਹੋਏ ਜੀ ਬਹੁਤ ਜ਼ਿਆਦੇ ਪਰੇਸ਼ਾਨ